ਹੈਲੋ ਸਤਿ ਸ਼੍ਰੀ ਅਕਾਲ ਬੋਲ ਰਹੇ ਹੋ ਮੈਂ ਭਾਅ ਜੀ ਅਭਿਸ਼ੇਕ ਬੋਲਦਾ ਸੀਗਾ ਮੈਂ ਭਾਅ ਜੀ ਉਹ ਪੁੱਛਣਾ ਸੀਗਾ ਹੁਸ਼ਿਆਰਪੁਰ 'ਚ ਵਧੀਆ ਕੋਲਜ ਕਿਹੜੇ ਆ ਸਰਕਾਰੀ ਚਲੋ ਸਰਕਾਰੀ ਦੱਸ ਦਿਓ ਪਹਿਲਾਂ ਭਾਅ ਜੀ ਕਿਹੜੇ ਵਧੀਆ ਆ ਮੇਰੀ ਭਾਅ ਜੀ ਬੀਕੌਮ ਹਾਂਜੀ ਹਾਂਜੀ ਇਹਨਾਂ ਦੀ ਫ਼ੀਸ ਵਗੈਰਾ ਕੀ ਹੋਊ ਜੀ ਇਹ ਪਰ ਸਮੈਸਟਰ ਨਾ ਪਰ ਸਮੈਸਟਰ ਹੈਨਾ ਅੱਛਾ ਸਾਲ ਸਾਰਾ ਠੀਕ ਹੈ ਠੀਕ ਹੈ ਅਤੇ ਭਾਅ ਜੀ ਪ੍ਰਾਈਵੇਟ ਕਿਹੜੇ ਕਿਹੜੇ ਆ ਹਾਂਜੀ ਅੱਛਾ ਅੱਛਾ ਇਹਨਾਂ ਦੀ ਫ਼ੀਸ ਕਿੰਨੀ ਹੋਊ ਭਾਅ ਜੀ ਅੱਛਾ ਅੱਛਾ ਭਾਅ ਜੀ ਇਹ ਡੀ ਏ ਵੀ ਕੋਲਜ ਕਿੱਧਰ ਆ ਇਸਲਾਮਾਬਾਦ ਅਤੇ ਇਹ ਐੱਸ ਡੀ ਅੱਛਾ ਗੌਰਮੈਂਟ ਕੋਲਜ ਠੀਕ ਹੈ ਠੀਕ ਹੈ ਅਤੇ ਭਾਅ ਜੀ ਇਹ ਆਪਣੇ ਬਾਕੀ ਦੋ ਜਿਹੜੇ ਰਿਆਤ ਬਹਾਰਾ ਅਤੇ ਜੀ ਐੱਨ ਏ ਹਾਂਜੀ ਇਹਨਾਂ ਦੇ ਕੋਲ ਪੀ ਜੀ ਹੋਸਟਲ ਵਗੈਰਾ ਮਿਲਜੂਗੇ ਮਤਲਬ ਨਾਲ ਹੀ ਕਿ ਥੋੜ੍ਹਾ ਬਹੁਤ ਦੂਰ ਜਾਣਾ ਪੈਣਾ ਹੋਸਟਲ ਮਤਲਬ ਜਿੱਦਾਂ ਵਧੀਆ ਵਾ ਕਿ ਇੱਦਾਂ ਗੰਦੇ ਗੁੰਦੇ ਜਿਹੇ ਆ ਠੀਕ ਹੈ ਹਾਂਜੀ ਹਾਂਜੀ ਉਹ ਤਾਂ ਚਲੋ ਨਹੀਂ ਹੁੰਦੀ ਫ਼ੀਸ ਕਿੰਨੀ ਕੁ ਹੋਊਗੀ ਭਾਅ ਜੀ ਅੱਛਾ ਅੱਛਾ ਜੀ ਹੋਰ ਤੁਸੀਂ ਕਿੱਥੋਂ ਵੈਸੇ ਕੀਤੀ ਅੱਛਾ ਅੱਛਾ ਉੱਥੇ ਕਿੱਦਾਂ ਦਾ ਭਾਅ ਜੀ ਮਾਹੌਲ ਵਗੈਰਾ ਸੀਗਾ ਵਧੀਆ ਸੀ ਤੁਸੀਂ ਕਿੱਥੇ ਪ੍ਰੈਫਰ ਕਰੁੰਗੇ ਵੈਸੇ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਮੇਰਾ ਇੱਕ ਦੋਸਤ ਹੈ ਉਹਨੇ ਇੰਜੀਨਰਿੰਗ ਕਰਨੀ ਉਹ ਕਿੱਥੋਂ ਕਰੇ ਅੱਛਾ ਅੱਛਾ ਹਾਂਜੀ ਠੀਕ ਠੀਕ ਹੈ ਭਾਅ ਜੀ ਚਲੋ ਠੀਕ ਆ ਫਿਰ ਭਾਅ ਜੀ ਭਾਅ ਜੀ ਭਾਅ ਜੀ ਇੱਕ ਹੋਰ ਚੀਜ਼ ਪੁੱਛਣੀ ਸੀ ਸਰਵਾਨੰਦ ਮਤਲਬ ਬੈਸਟ ਹੈ ਨਾ ਇੰਜਿਨਰਿੰਗ ਲਈ ਠੀਕ ਠੀਕ ਹੈ ਚਲੋ ਥੈਂਕ ਉ